ਹਿੰਦੀ ਪੰਜਾਬੀ ਨਿਊਜ ਚੈਨਲ ਨੂੰ ਮੈਂ ਜ਼ਿਆਦਾ ਦੇਖਦੀ ਹਾਂ ਪੀ ਟੀ ਸੀ ਨਿਊਜ ਏ ਬੀ ਪੀ ਪੰਜਾਬੀ ਜੀ ਪੰਜਾਬੀ ਚ ਚੜ੍ਹਦੀ ਕਲਾ ਪੰਜਾਬੀ ਆਜ ਤੱਕ ਡੀ ਡੀ ਨਿਊਜ ਇੰਡੀਆ ਟੀ ਵੀ ਫੌਜ ਇੰਡੀਆ ਪੰਜਾਬ ਨਿਊਜ ਖਬਰਾਂ 'ਚ ਧਾਰਮਿਕ ਪੰਜਾਬ ਦੀਆਂ ਖਬਰਾਂ ਪੰਜਾਬ ਬਾਰੇ ਦੱਸਦੇ ਆ ਹਿੰਦੀ ਚੈਨਲ ਵਾਲੇ ਪੂਰੇ ਭਾਰਤ ਦੀਆਂ ਖਬਰਾਂ ਨੂੰ ਕਵਰ ਕਰਦੇ ਆ